ਹਾਂ ਮੈਂ ਮੱਧ ਪੀੜ੍ਹੀ ਦਾ ਹਿੱਸਾ ਹਾਂ ਜੋ ਕਿ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਵਿਚਕਾਰ ਸੰਤੁਲਨ ਦਾ ਪ੍ਰਬੰਧਨ ਅਤੇ ਕੋਸ਼ਿਸ਼ ਕਰਦਾ ਹੈ ਇਹ ਦੋਨੋਂ ਵੱਖ ਵੱਖ ਸੰਸਾਰ ਹੈ ਹਾਂ ਮੈਂ ਦੋਵਾਂ ਪੀੜ੍ਹੀਆਂ ਸਮਾਨਤਾਵਾਂ ਅਤੇ ਇਹਨਾਂ ਪੀੜ੍ਹੀਆਂ ਵਿਚਕਾਰ ਅੰਤਰ ਨੂੰ ਸੰਭਾਲਣ ਦੇ ਆਪਣੇ ਅਨੁਭਵ ਬਾਰੇ ਦੱਸ ਸਕਦਾ ਹਾਂ ਜਿਵੇਂ ਕਿ ਅੱਜ ਕੱਲ੍ਹ ਅੱਜ ਕੱਲ੍ਹ ਦੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਦੀ ਸੋਚ ਬਹੁਤ ਅਲੱਗ ਹੈ ਪਰੰਤੂ ਜਿਹੜੀ ਪੁਰਾਣੀ ਪੀੜ੍ਹੀ ਹੈ ਉਹਨਾਂ ਨੂੰ ਉਹਨਾਂ ਦੀ ਸੋਚ ਵੀ ਬਹੁਤ ਉਹਨਾਂ ਨਾਲੋਂ ਅਲੱਗ ਹਨ ਪੁਰਾਣੀ ਪੀੜ੍ਹੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਸੱਭਿਆਚਾਰ ਵਿੱਚ ਜੋ ਜੋ ਚੱਲ ਰਿਹਾ ਹੈ ਉਹ ਸਾਨੂੰ ਕਿਵੇਂ ਕਿਵੇਂ ਕਰਨਾ ਚਾਹੀਦਾ ਹੈ ਪਰੰਤੂ ਨਵੀਂ ਪੀੜ੍ਹੀ ਸਾਨੂੰ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਵੇਂ ਕਿਵੇਂ ਦੇ ਬਦਲਾਵ ਸਾਨੂੰ ਦੇਖ ਦੇਖੇ ਜਾ ਸਕਦੇ ਹਨ ਪੁਰਾਣੀ ਪੀੜ੍ਹੀ ਨੂੰ ਨਵੀਂ ਪੀੜ੍ਹੀ ਤੋਂ ਵੀ ਬਦਲਾਵ ਜਿਹੜੇ ਹੋਣ ਵਾਲੇ ਹਨ ਉਹ ਸਿੱਖਣੇ ਚਾਹੀਦੇ ਹੈ ਅਤੇ ਉਹਨਾਂ ਪਰ ਗੌਰ ਕਰਨਾ ਚਾਹੀਦਾ ਹੈ ਪਰੰਤੂ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਵੀ ਪੁਰਾਣੀ ਪੀੜ੍ਹੀ ਤੋਂ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਭੁੱਲ ਨਹੀਂ ਸਕਦੇ ਅਤੇ ਉਨ੍ਹਾਂ ਨੂੰ ਅਪਣਾਉਣਾ ਵੀ ਸਾਡੇ ਲਈ ਕਿੰਨਾ ਮਹੱਤਵਪੂਰਨ ਹੈ